ਜੇਕਰ ਹੈਲਥ ਰਿਲੇਟਿਡ ਗੱਲ ਕੀਤੀ ਜਾਏ ਤਾਂ ਅੱਜ ਕੱਲ੍ਹ ਤਾਂ ਹਰ ਸ਼ਹਿਰ ਵਿੱਚ ਕਿਤੇ ਨਾ ਕਿਤੇ ਕੈਂਪ ਲੱਗ ਰਹੇ ਹਨ ਜਿਸ ਵਿੱਚ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਉਸ ਵਿੱਚ ਅੱਜ ਕੱਲ੍ਹ ਵੈਕਸੀਨੇਸ਼ਨ ਦਾ ਵੀ ਲੋਕ ਨੈੱਟ ਥਰੂ ਹਰ ਚੀਜ਼ ਬਾਰੇ ਪਤਾ ਕਰਦੇ ਹਨ ਜਿਸ ਵਿੱਚ ਅੱਜ ਕੱਲ੍ਹ ਸਕੂਲਾਂ ਵਿੱਚ ਵੀ ਹਰ ਤਰ੍ਹਾਂ ਦੇ ਕੈਂਪ ਲਾਏ ਲਗਾਏ ਜਾ ਰਹੇ ਹਨ ਜਿਸ ਵਿੱਚ ਬੱਚਿਆਂ ਦੀ ਵੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਹਰ ਪ੍ਰਕਾਰ ਦੇ ਬੱਚਿਆਂ ਨੂੰ ਹੁਣ ਪਿੱਛੇ ਜਿਹੜੀ ਵੀ ਵੈਕਸੀਨ ਆ ਜਿਹੜੀ ਕੋਵਿਡ ਦੀਆਂ ਲੱਗੀਆਂ ਉਸ ਨੂੰ ਵੀ ਹਰ ਪ੍ਰਕਾਰ ਦੇ ਕੈਂਪ ਲਗਾ ਕੇ ਬੱਚਿਆਂ ਨੂੰ ਵੱਡਿਆਂ ਨੂੰ ਔਰਤਾਂ ਨੂੰ ਸਾਰਿਆਂ ਨੂੰ ਵੈਕਸੀਨੇਸ਼ਨ ਲਗਾਈ ਗਈ ਹੈ ਤਾਂ ਜੋ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਤੰਗੀ ਨਾ ਕੀਤੀ ਜਾਏ ਅੱਜ ਕੱਲ੍ਹ ਪਿਛਲੇ ਸਮਿਆਂ ਦੇ ਵਿੱਚ ਤਾਂ ਪਿੰਡਾਂ ਵਿੱਚ ਹਰ ਤਰ੍ਹਾਂ ਦੇ ਕੈਂਪ ਲੱਗਦੇ ਸਨ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਸ਼ਹਿਰਾਂ ਵਿੱਚ ਵੀ ਹਰ ਪ੍ਰਕਾਰ ਦੇ ਕੈਂਪ ਲੱਗੇ ਜਾ ਰਹੇ ਹਨ ਬਾਕੀ ਅਗਰ ਕਿਸੇ ਨੇ ਕਿ ਚੀਜ਼ ਬਾਰੇ ਪੁੱਛਣਾ ਹੋਵੇ ਤਾਂ ਅਸੀਂ ਅੱਜ ਕੱਲ੍ਹ ਨੈਟ ਥਰੂ ਵੀ ਹਰ ਚੀਜ਼ ਮਿਲ ਕੇ ਪਤਾ ਜਾਣ ਸਕਦੇ ਹਾਂ ਅਸੀਂ ਨੈੱਟ ਥਰੂ ਹਰ ਚੀਜ਼ ਬਾਰੇ ਪਤਾ ਕਰ ਲੈਂਦੇ ਕਿੱਥੇ ਕੈਂਪ ਲੱਗ ਰਿਹਾ ਜਾਂ ਕਿੱਥੇ ਹਰ ਪ੍ਰਕਾਰ ਦੇ ਟੈਸਟ ਕੀਤੇ ਜਾਂਦੇ ਹਨ ਤਾਂ ਜੋ ਕਿ ਅਸੀਂ ਜਾ ਕੇ ਕਰਵਾ ਲਿਆ ਅੱਜ ਕੱਲ੍ਹ ਡੀ ਟੀ ਟੀ ਸਪਰੇਅ ਵੀ ਕੀਤੀ ਜਾ ਰਹੀ ਹੈ ਜਿਸ ਕਰਕੇ ਕੋਈ ਕਿਸੀ ਚੀਜ਼ ਦੀ ਕਿਸੀ ਚੀਜ਼ ਦੀ ਕੋਈ ਤੰਗੀ ਨਹੀਂ ਹੋ ਰਹੀ ਮੱਛਰਾਂ ਲਈ ਵੀ ਅੱਜ ਕੱਲ੍ਹ ਸਪਰੇਅ ਚੱਲ ਰਹੀ ਹੈ ਇੱਕ ਦੋ ਦਿਨ ਤੱਕ ਸਪਰੇਅ ਹੁੰਦੀ ਹੈ ਤਾਂ ਜੋ ਕਿ ਘਰਾਂ ਵਿੱਚ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਘਟਨਾ ਨਾ ਹੋਏ ਹਰ ਚੀਜ਼ ਤੋਂ ਸਾਵਧਾਨੀ ਵਰਤੀ ਜਾ ਰਹੀ ਹੈ ਤਾਂ ਜੋ ਕਿ ਬੱਚੇ ਵੀ ਸੇਫ ਰਹਿਣ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਪ ਹਰ ਲੋਕ ਵੀ ਸੇਫ ਰਹਿਣ